ਹਾਂਜੀ ਮੈਂ ਸੋਸ਼ਲ ਮੀਡੀਆ ਯੂਜ ਕਰਦਾ ਹਾਂ ਅਤੇ ਮੈਂ ਉੱਥੇ ਆਪਣੀ ਫੋਟੋ ਵੀ ਕਦੀ ਕਦੀ ਪਾ ਦਿੰਦਾ ਹਾਂ ਮੈਂ ਇੰਸਟਾਗ੍ਰਾਮ ਨਾਮ ਦਾ ਐਪ ਯੂਜ ਕਰਦਾ ਹਾਂ ਜਿੱਥੇ ਜ਼ਿਆਦਾਤਰ ਸਾਰੀਆਂ ਚੀਜ਼ਾਂ ਹੈਗੀਆਂ ਜਿੱਦਾਂ ਲੋਕਾਂ ਨੂੰ ਮੈਸੇਜ ਵਗੈਰਾ ਕਰਨਾ ਜਾਂ ਫਿਰ ਆਪਣੀ ਫੋਟੋਆਂ ਪਾਉਣਾ ਜਾਂ ਕਿ ਦੂਜੇ ਲੋਕਾਂ ਦੀਆਂ ਫੋਟੋਆਂ ਵਗੈਰਾ 'ਤੇ ਉਹ ਕੀ ਕਰਦੇ ਪਏ ਇਸ ਟਾਈਮ 'ਤੇ ਇਹ ਦੇਖਣਾ ਵਗੈਰਾ ਮੈਂ ਮੈਨੂੰ ਜ਼ਿਆਦਾ ਇੰਨਾ ਸ਼ੌਂਕ ਨਹੀਂ ਹੈਗਾ ਫੋਟੋਆਂ ਪੋਸਟ ਕਰਨ ਦਾ ਪਰ ਕਦੀ ਕਦੀ ਕਿਸੇ ਦੋ ਜਾਂ ਤਿੰਨ ਮਹੀਨ ਦੋ ਜਾਂ ਤਿੰਨ ਮਹੀਨਿਆਂ ਵਿੱਚ ਇੱਕ ਵਾਰੀ ਮੈਂ ਕਰ ਦਿੰਦਾ ਹਾਂ ਉਹ ਆਪਣੇ ਵਾਸਤੇ ਇੱਕ ਕਿ ਇਹ ਰਿਕਾਰਡ ਜਿਹਾ ਬਣ ਜਾਂਦਾ ਕਿ ਪਹਿਲਾਂ ਤੋਂ ਕਿੰਨਾ ਇੰਪਰੂਵ ਕੀਤਾ ਆਪਣੇ ਆਪ ਨੂੰ ਜਾਂ ਲੋਕਾਂ ਨੂੰ ਦੱਸਣਾ ਕਿ ਕੀ ਹੁੰਦਾ ਪਿਆ ਮੇਰੀ ਲਾਈਫ 'ਚ ਹਜੇ ਅਤੇ ਵੱਖਰੀਆਂ ਵੱਖਰੀਆਂ ਚੀਜ਼ਾਂ ਵਾਸਤੇ ਜ਼ਿਆਦਾਤਰ ਸੋਸ਼ਲ ਮੀਡੀਆ ਮੈਂ ਉਦਾਂ ਕੀ ਆ ਲੋਕਾਂ ਦੀਆਂ ਸਟੋਰੀਆਂ ਵਗੈਰਾ ਵੇਖਣ ਵਾਸਤੇ ਕਿ ਲੋਕ ਕੀ ਕਰਦੇ ਪਏ ਹੈ ਜਾਂ ਫਿਰ ਰੀਲਾਂ ਵਗੈਰਾ ਜਿੱਥੇ ਲੋਕ ਹਸੀ ਮਜ਼ਾਕ ਵਾਸਤੇ ਮੀਮਸ ਵਗੈਰਾ ਦਸ ਬਣਾਉਂਦੇ ਆ ਉਹ ਵੇਖਦਾ ਹਾਂ